ਪੰਜਾਬੀ ਭਾਸ਼ਾ ਬਾਰੇ ਇਤਿਹਾਸਕਾਰ ਲਿਖਦੇ ਹਨ ਕਿ ਇਹ ਪਚਵੰਜਾ ਸੌ ਸਾਲ ਪੁਰਾਣੀ ਹੈ ਇਸ ਦਾ ਮੁੱਢ ਇੰਡੋ ਆਰੀਅਨ ਸਮੇਂ ਦੇ ਵਿੱਚ ਵੇਖਿਆ ਗਿਆ ਸੀ ਅਤੇ ਮਾਡਰਨ ਯੁੱਗ ਦੇ ਵਿੱਚ ਗੁਰੂ ਅੰਗਦ ਦੇਵ ਜੀ ਨੇ ਪਹਿਲੀ ਵਾਰ ਗੁਰਮੁਖੀ ਲਿਪੀ ਦੀ ਵਰਤੋਂ ਕੀਤੀ ਸੀ ਇਹ ਲਹਿੰਦੇ ਪੰਜਾਬ ਤੋਂ ਸੋਧੀ ਗਈ ਸੀ ਜਿਸ ਵਿੱਚ ਪੰਜਾਬੀ ਸਿੰਧੀ ਸਰਾਇਕੀ ਅਤੇ ਹਿੰਦੋ ਕੋ ਭਾਸ਼ਾ ਲਿਖਣ ਲਈ ਵਰਤੀਆਂ ਜਾਂਦੀਆਂ ਸੀ ਆਧੁਨਿਕ ਪੰਜਾਬੀ ਜਿਹੜੀ ਹੈ ਉਹ ਉੱਨੀਵੀਂ ਸਦੀ ਵਿੱਚ ਮੱਧ ਕਾਲੀਨ ਪੰਜਾਬੀ ਸਟੇਜ ਤੋਂ ਨਿਕਲੀ ਸੀ ਅਤੇ ਇਹ ਦੋ ਤਰ੍ਹਾਂ ਦੀ ਪੰਜਾਬੀ ਹੈ ਲਹਿੰਦੇ ਪੰਜਾਬ ਦੀ ਅਲੱਗ ਹੈ ਅਤੇ ਚੜਦੇ ਪੰਜਾਬ ਦੀ ਅਲੱਗ ਇਸ ਦੇ ਵਿੱਚ ਜੇ ਹੁਣ ਤੁਸੀਂ ਦੇਖੋ ਮਾਝੀ ਦੁਆਬੀ ਮਲਵਈ ਪੁਆਧੀ ਇਹ ਚਾਰ ਏਰੀਆ ਦੇ ਹਿਸਾਬ ਦੇ ਨਾਲ ਭਾਸ਼ਾਵਾਂ ਬਦਲ ਗਈਆਂ ਹਨ ਲਿਖਣ ਵਿੱਚ ਪਹਿਲਾਂ ਭਾਸ਼ਾ ਫ਼ਰਕ ਸੀ ਜਿਹੜੀ ਪਹਿਲੀ ਸਾਹਿਤ ਦੀ ਤੁਸੀਂ ਰਚਨਾਵਾਂ ਵੇਖਦੇ ਹੋ ਜਾਂ ਗੁਰੂ ਗ੍ਰੰਥ ਸਾਹਿਬ ਵੇਲੇ ਵਰਤੀਆਂ ਗਈਆਂ ਜਾਂ ਪਹਿਲੇ ਜਿਹੜੇ ਕੋਈ ਕਵਿਤਾਵਾਂ ਲਿਖੀਆਂ ਗਈਆਂ ਸੀ ਉਹਨਾਂ ਦੇ ਵਿੱਚ ਬੋਲਣ ਵਿੱਚ ਥੋੜ੍ਹੀ ਟੋਨ ਹੋਰ ਸੀ ਪਰ ਹੁਣ ਜਿਹੜੀ ਟਕਸਾਲੀ ਲੈਂਗੁਏਜ ਆ ਉਸ ਮਾਝੀ ਮਾਝੇ ਏਰੀਏ ਦੀ ਲੈਂਗੁਏਜ ਨੂੰ ਟਕਸਾਲੀ ਲੈਂਗੁਏਜ ਮੰਨਿਆ ਜਾਂਦਾ ਹੈ ਬਹੁਤ ਸਾਰੇ ਡਾਇਲੈਕਟ ਦੇ ਵਿੱਚ ਫ਼ਰਕ ਪੈ ਗਿਆ ਇਹ ਪੰਜਾਬੀ ਮੇਨਲੀ ਆਪਣੀ ਟੋਨਜ਼ ਕਰਕੇ ਫ਼ਰਕ ਆ ਨਹੀਂ ਤਾਂ ਇਹਦੇ ਵਰਡ ਕਈ ਹਿੰਦੀ ਵਾਲੇ ਜਾਂ ਇੰਗਲਿਸ਼ ਵਾਲੇ ਵੀ ਵਰਡ ਵਿੱਚੇ ਵਰਤੇ ਜਾਂਦੇ ਨੇ ਜਿੱਦਾਂ ਸਕੂਲ ਆ ਸਕੂਲ ਇੰਗਲਿਸ਼ ਦਾ ਵੀ ਵਰਡ ਹੈ ਪ ਪਰ ਪੰਜਾਬੀ ਵਿੱਚ ਵਰਤਿਆ ਜਾਂਦਾ ਹੈ ਇਹ ਬਹੁਤ ਸਾਰੇ ਸ਼ਬਦ ਨੇ ਜਿਹੜੇ ਹੌਲੀ ਹੌਲੀ ਚੇਂਜ ਹੋ ਕੇ ਪਰ ਮੇਨ ਟੋਨਸ ਦੇ ਨਾਲ ਆ ਗਏ ਪਰ ਅੱਜ ਦੀ ਡੇਟ ਦੇ ਵਿੱਚ ਜੋ ਟਕਸਾਲੀ ਲੈਂਗੁਏਜ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਸਰਕਾਰੀ ਲੈਂਗੁਏਜ ਜਾਂ ਲਿਖਣ ਵਿੱਚ ਜਿਹੜੀ ਲੈਂਗੁਏਜ ਆਉਂਦੀ ਹੈ ਪੰਜਾਬੀ ਉਹ ਮਾਝੇ ਵਾਲੀ ਮਾਝੇ ਦੇ ਏਰੀਏ ਦੀ ਲੈਂਗੁਏਜ